ਭੰਗੜਾ ਇੱਕ ਲੋਕ ਪ੍ਰਸਿੱਧ ਡਾਂਸ ਹੈ ਇਹਦੇ ਸਟੈਪ ਮਾਲ ਕੰਧੇ ਦੀ ਚੌੜਾਈ 'ਤੇ ਰੱਖ ਕੇ ਗੋਡਿਆਂ ਨੂੰ ਮੋੜ ਕੇ ਸ਼ੁਰੂ ਕਰਦੇ ਹਨ ਫੂਲ ਪੰਜਾ ਅਤੇ ਪੰਪਤਾਰੀ ਇਹ ਲੋਕ ਭੰਗੜਾ ਹੈ ਤੀਸਰਾ ਸਿੰਗਲ ਜਾਫ਼ਾ ਅਤੇ ਡਬਲ ਜਾਫ਼ਾ ਦੇਖਿਆ ਜਾਵੇ ਤਾਂ ਇਹ ਵੈਸਾਖੀ ਦੇ ਤਿਓਹਾਰ 'ਤੇ ਕੀਤਾ ਜਾਂਦਾ ਹੈ ਪਰੰਪਰਿਕ ਭੰਗੜੇ ਵਿੱਚ ਪੰਜਾਬੀ ਡਾਂਸ ਲੁੱਡੀ ਝੂਮਰ ਧਮਾਲ ਜਿਹੇ ਡਾਂਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ